ਹੈਲੋ ਸਤਿ ਸ਼੍ਰੀ ਅਕਾਲ ਜੀ ਕੈਬ ਸਰਵਿਸ ਤੋਂ ਬੋਲ ਰਹੇ ਹੋ ਮੈਂ ਨਾ ਤਕਰੀਬਨ ਅੱਧਾ ਘੰਟਾ ਪਹਿਲਾਂ ਤੁਹਾਡੀ ਕੈਬ ਸਰਵਿਸ 'ਚ ਕਾਲ ਕੀਤੀ ਸੀ ਅਤੇ ਉੱਥੇ ਇੱਕ ਰਾਈਡ ਬੁੱਕ ਕੀਤੀ ਸੀ ਮੈਂ ਨਾ ਏਰਪੋਰਟ 'ਤੇ ਖੜ੍ਹਿਆ ਹੋਇਆਂ ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਕਿੰਨੇ ਕੁ ਸਮੇਂ ਦੇ ਵਿੱਚ ਤੁਹਾਡਾ ਡਰਾਈਵਰ ਮੇਰੇ ਤੱਕ ਪੁੱਜਦਾ ਹੋ ਜਾਏਗਾ ਕਿਰਪਾ ਕਰਕੇ ਇਹ ਸਭ ਮੈਨੂੰ ਦੱਸਣ ਦੀ ਖੇਚਲ ਕਰਨਾ ਕਿਉਂਕਿ ਮੈਂ ਅੱਗੇ ਵੀ ਕਿਤੇ ਜ਼ਰੂਰੀ ਮੀਟਿੰਗ 'ਤੇ ਜਾਣਾ ਹੈ ਸੋ ਕ੍ਰਿਪਾ ਕਰਕੇ ਤੁਸੀਂ ਆਪਣੇ ਡਰਾਈਵਰ ਨੂੰ ਜਲਦੀ ਭੇਜਣ ਦੀ ਕੋਸ਼ਿਸ਼ ਕਰਨੀ ਜੀ ਧੰਨਵਾਦ